ਮੇਰੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਫੈਸਲਾ ਸੀ ਮੈਂ ਆਪਣੇ ਪਤੀ ਤੋਂ ਅਲੱਗ ਹੋਈ ਜੋ ਕਿ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਸੀ ਪਰ ਕੋਈ ਇੱਦਾਂ ਦਾ ਟਾਈਮ ਵੀ ਸੀ ਕਿ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਉਸ ਤੋਂ ਅਲੱਗ ਹੋਵਾਂ ਜਾਂ ਨਾ ਹੋਵਾਂ ਪਰ ਉਸ ਨੇ ਮੈਨੂੁੰ ਇੰਨਾਂ ਜ਼ਿਆਦਾ ਟੋਰਚਰ ਕੀਤਾ ਕਿ ਅਖੀਰ ਵਿੱਚ ਮੈਨੂੰ ਇਹ ਫੈਸਲਾ ਲੈਣਾ ਪਿਆ ਉਹਨੇ ਜਿੱਦਾਂ ਕੇ ਮੇਰੇ ਨਾਲ ਕੁੱਟਮਾਰ ਕਰਨੀ ਮੈਨੂੰ ਘਰ ਖਰਚ ਲਈ ਪੈਸੇ ਨਹੀਂ ਦੇਣੇ ਹੈਗੇ ਹਰੇਕ ਗੱਲ 'ਤੇ ਟੋਰਚਰ ਕਰਨਾ ਕਿਸੇ ਨੂੰ ਬੁਲਾਉਣ ਨਹੀਂ ਦੇਣਾ ਹੈਗਾ ਮੈਂ ਕਿਸੇ ਲੇਡੀ ਨਾਲ ਵੀ ਗੱਲ ਨਹੀਂ ਸੀ ਕਰ ਸਕਦੀ ਹੈਗੀ ਮੇਰੇ ਸਰੀਰ 'ਤੇ ਕੁੱਟਾਂ ਮਾਰਾਂ ਦੇ ਨਿਸ਼ਾਨ ਵੀ ਹੁਣ ਤੱਕ ਹੈ ਮੈਂ ਆਪਣੇ ਘਰ ਨੂੰ ਵਸਾਉਣ ਲਈ ਬਹੁਤ ਟਾਈਮ ਦਿੱਤਾ ਪਰ ਮੇਰੇ ਹਸਬੈਂਡ ਨੇ ਮੇਰੀ ਸਪੋਟ ਨਹੀਂ ਕੀਤੀ ਹੈ ਤਾਂ ਅਖੀਰ ਵਿੱਚ ਮੈਨੂੰ ਇਹ ਫੈਸਲਾ ਲੈਣਾ ਪਿਆ ਵੀ ਮੈਨੂੰ ਇਸ ਤੋਂ ਅਲੱਗ ਹੋ ਜਾਣਾ ਚਾਹੀਦਾ ਸੀ ਕਿਉਂਕਿ ਉਹ ਜਿਸ ਹਿਸਾਬ ਨਾਲ ਨਸ਼ੇ ਕਰਦਾ ਸੀ ਨਾ ਮੇਰੇ ਦੋ ਬੱਚੇ ਆ ਉਹਨਾਂ 'ਤੇ ਬਹੁਤ ਜ਼ਿਆਦਾ ਗਲਤ ਅਸਰ ਪੈ ਰਿਹਾ ਤਾ ਔਰ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਬੱਚੇ ਉਸ ਲਾਈਨ ਵਿੱਚ ਜਾਣ ਉਸ ਟਾਈਮ ਮੈਂ ਕੋਈ ਕੰਮ ਵੀ ਨਹੀਂ ਸੀ ਕਰਦੀ ਮੈਨੂੰ ਇਹ ਵੀ ਸੀ ਡਰ ਕਿ ਅਗਰ ਮੈਂ ਉਸ ਤੋਂ ਅਲੱਗ ਹੋ ਗਈ ਤਾਂ ਮੈਂ ਆਪਣੇ ਬੱਚੇ ਕਿੱਦਾਂ ਪਾਲਾਂਗੀ ਕਿਉਂਕਿ ਮੇਰੇ ਪਾਸ ਕੋਈ ਕੰਮ ਨਹੀਂ ਸੀ ਔਰ ਮੈਂ ਜ਼ਿਆਦਾ ਪੜ੍ਹੀ ਲਿਖੀ ਵੀ ਨਹੀਂ ਤੀ ਪਰ ਫਿਰ ਵੀ ਜਦੋਂ ਉਸ ਦੇ ਹਰਕਤਾਂ ਦੇਖੀਆਂ ਫਿਰ ਮੈਨੂੰ ਇਹ ਫੈਸਲਾ ਲੈਣਾ ਪਿਆ ਇਸ ਫੈਸਲੇ 'ਚ ਮੈਂ ਆਪਣੇ ਮੇਰੇ ਇਸ ਫੈਸਲੇ 'ਚ ਨਾ ਮੇਰੇ ਮੰਮੀ ਪਾਪਾ ਨੇ ਮੇਰੀ ਬਹੁਤ ਮਦਦ ਕੀਤੀ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਅਗਰ ਤੂੰ ਇੰਨੀ ਜ਼ਿਆਦਾ ਦੁਖੀ ਆ ਤਾਂ ਤੂੰ ਅਲੱਗ ਹੋ ਜਾ ਪਰ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਅਲੱਗ ਹੋ ਜਾਵਾਂਗੀ ਪਰ ਮੈਂ ਬੱਚੇ ਨਹੀਂ ਆਪਣੇ ਛੱਡਣੇ ਹੈਗੇ ਕਿਉਂਕਿ ਉਹ ਇੱਕ ਨਸ਼ੇੜੀ ਆਦਮੀ ਸੀ ਜੇ ਮੈਂ ਉਹਦੇ ਕੋਲ ਛੱਡਦੀ ਤਾਂ ਮੇਰੇ ਬੱਚਿਆਂ ਦੀ ਵੀ ਅੱਜ ਜ਼ਿੰਦਗੀ ਨਰਕ ਬਣ ਜਾਣੀ ਤੀ ਮੇਰੇ ਮੰਮੀ ਪਾਪਾ ਨੇ ਸਪੋਰਟ ਕੀਤੀ ਹੈ ਮੇਰੇ ਫੈਸਲੇ ਵਿੱਚ ਉਹ ਮੇਰੇ ਨਾਲ ਸੀ ਮੈਂ ਉਸ ਤੋਂ ਅਲੱਗ ਹੋ ਚੁੱਕੀ ਹਾਂ ਮੇਰੇ ਮਾਂ ਬਾਪ ਹੁਣ ਤੱਕ ਮੇਰੇ ਸਹਾਰਾ ਬਣੇ ਹੋਏ ਆ ਔਰ ਮੈਂ ਹੁਣ ਇੱਕ ਕੰਮ ਵੀ ਮੈਨੂੰ ਮਿਲ ਗਿਆ ਛੋਟਾ ਜਾ ਜਿਸ ਹਿਸਾਬ ਨਾਲ ਮੇਰੀ ਪੜ੍ਹਾਈ ਤੀ ਉਸ ਹਿਸਾਬ ਨਾਲ ਮੈਨੂੰ ਛੋਟਾ ਕੰਮ ਮਿਲ ਗਿਆ ਔਰ ਮੈਂ ਅੱਜ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਆਪਣੇ ਬੱਚੇ ਪੜ੍ਹਾ ਲਿਖਾ ਰਹੀ ਹਾਂ ਇਸ ਨੌਕਰੀ ਦੇ ਸਿਰ 'ਤੇ ਔਰ ਮੈਨੂੰ ਇਸ ਨਾ ਆਪਣੇ ਹਸਬੈਂਡ ਤੋਂ ਅਲੱਗ ਹੋਣ ਦੇ ਫੈਸਲੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਕੋਈ ਦੁੱਖ ਨਹੀਂ ਹੈ ਅੱਜ ਮੈਂ ਉਸ ਤੋਂ ਅਲੱਗ ਹੋ ਕੇ ਖੁਸ਼ ਹਾਂ ਔਰ ਸਟੈਂਡ ਕਰਦੀ ਹਾਂ ਆਪਣੇ ਪੈਰਾਂ 'ਤੇ ਕਿ ਮੈਂ ਅੱਜ ਆਪਣਾ ਘਰ ਵੀ ਹੈ ਔਰ ਕੰਮ ਵੀ ਕਰ ਰਹੀ ਹਾਂ ਔਰ ਆਪਣੇ ਬੱਚੇ ਵੀ ਪਾਲ਼ ਰਹੀ ਹਾਂ ਅਸੀਂ ਅੱਜ ਤਿੰਨੇ ਜਾਣੇ ਬਹੁਤ ਖੁਸ਼ ਹਾਂ ਉਸ ਤੋਂ ਅਲੱਗ ਹੋ ਕੇ